ਸਕੂਲ ਸਮੇਂ ਵਿੱਚ ਮੈਂ ਟੀਚਰ ਡੇ 'ਤੇ ਆਪਣੇ ਅਧਿਆਪਕ ਮੁੱਖ ਅਧਿਆਪਕ ਸਰ ਨੂੰ ਇੱਕ ਹੱਥ ਨਾਲ ਬਣਾ ਕੇ ਕਾਰਡ ਤੋਹਫੇ ਵਜੋਂ ਦਿੱਤਾ ਸੀ ਜੋ ਬਹੁਤ ਦੇਖਣ ਵਿੱਚ ਬਹੁਤ ਮਖੌਲੀਆ ਸੀ ਜਦੋਂ ਮੈਂ ਅਧਿਆਪਕ ਸਾਹਿਬਾਨ ਨੂੰ ਇਹ ਦਿੱਤਾ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਵੀ ਬਹੁਤ ਕੁਝ ਬਿਆਨ ਕਰ ਰਹੀ ਸੀ ਉਨ੍ਹਾਂ ਨੇ ਮੇਰੀ ਸਹਾਰਨਾ ਵੀ ਕੀਤੀ ਅਤੇ ਇਸ ਚੀਜ਼ ਨੂੰ ਸੁਧਾਰਨ ਬਾਰੇ ਮੈਨੂੰ ਕੁਝ ਸੁਝਾਅ ਵੀ ਦਿੱਤੇ ਅਤੇ ਇਸ ਤੋਂ ਅਗਲੇ ਸਾਲ ਮੈਂ ਇੱਕ ਹੋਰ ਕਾਰਡ ਬਣਾਇਆ ਜਿਸ ਵਿੱਚ ਮੈਂ ਕਾਫੀ ਹੱਦ ਤੱਕ ਸੁਧਾਰਿਆ ਅਤੇ ਬਹੁਤ ਕੁਝ ਸਿੱਖਿਆ ਵੀ